ਹਾਂਜੀ ਅਮਰ ਬੇਟਾ ਤੁਸੀਂ ਆਪਣਾ ਸੁਣਾਓ ਤੁਸੀਂ ਹੋਸਟਲ ਹਾਂ ਤੁਸੀਂ ਹੋਸਟਲ ਪਹੁੰਚ ਗਏ ਹੋ ਤਾਂ ਤੁਹਾਡੇ ਹੋਸਟਲ ਦਾ ਅ ਬ ਅ ਠੀਕ ਆ ਹਿਸਾਬ ਕਿਤਾਬ ਕਮਰਾ ਰੂਮ ਕਿਸ ਤਰ੍ਹਾਂ ਦਾ ਤੁਹਾਡਾ ਹਾਂ ਅਤੇ ਉੱਥੇ ਵੈ ਪੱਖੇ ਵਗੈਰਾ ਹਾਂ ਜਿਹੜੇ ਹਾਂ ਜਿਹੜੇ ਤੁਹਾਡੇ ਟੀਚਰ ਆ ਤਾਂ ਉਹ ਤੁਹਾਡੇ ਨਾਲ ਠੀਕ ਚੱਲ ਰਹੇ ਨੇ ਹਾਂ ਠੀਕ ਆ ਜਿਹੜੇ ਤੁਹਾਡੇ ਨਾਲ ਹੋਸਟਲ 'ਚ ਲੜਕੀਆਂ ਨੇ ਉਹ ਠੀਕ ਚੱਲ ਰਹੀਆਂ ਨੇ ਠੀਕ ਆ ਅਤੇ ਅਯੈ ਖਾਣਾ ਵਗੈਰਾ ਕਿਸ ਤਰ੍ਹਾਂ ਮਿਲ ਰਿਹਾ ਹਾਂ ਠੀਕ ਆ ਕੋਈ ਦਿੱਕਤ ਤਾਂ ਨਹੀਂ ਹੈਗੀ ਹਾਂ ਚਲੋ ਠੀਕ ਠੀਕ ਆ